ਹਾਂ ਸੋਸ਼ਲ ਮੀਡੀਆ ਅਕਾਊਂਟ ਹੈਕ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ ਇਹ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਕਦੋਂ ਕਿਵੇਂ ਤੇ ਕਿਸੇ ਦੇ ਅਕਾਊਂਟ ਨੂੰ ਹੈਕ ਕੀਤਾ ਜਾ ਸਕਦਾ ਹੈ ਪਰ ਜੇਕਰ ਤੁਹਾਡਾ ਜਾਂ ਤੁਹਾਡੇ ਦੋਸਤ ਦਾ ਅਕਾਊਂਟ ਹੈਕ ਹੋ ਜਾਵੇ ਤਾਂ ਕੁਛ ਮਹੱਤਵਪੂਰਨ ਗੱਲਾਂ ਹਨ ਜਿਹਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਫਿਰ ਕਾਰਵਾਈ ਕੀਤੀ ਜਾ ਸਕਦੀ ਹੈ ਜੇ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲੋਗਿੰਨ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਪਾਸਵਰਡ ਕੰਮ ਨਹੀਂ ਕਰਦਾ ਜਾਂ ਅਜੇ ਪਾਸਵਰਡ ਦੀ ਸੂਚਨਾ ਮਿਲਦੀ ਹੈ ਤਾਂ ਇਹ ਇੱਕ ਚਿੰਤਾ ਦਾ ਸਬੱਬ ਹੋ ਸਕਦਾ ਹੈ ਤੁਹਾਡਾ ਅਕਾਊਂਟ ਹੈਕ ਹੋ ਗਿਆ ਹੈ ਜੇ ਤੁਸੀਂ ਦੇਖਦੇ ਹੋ ਕਿ ਤੁਹਾਡੇ ਅਕਾਊਂਟ ਤਾਂ ਅਜੀਬ ਜਾਂ ਤੁਸੀਂ ਨਾ ਕੀਤੀਆਂ ਪੋਸਟਾਂ ਜਾਂ ਟਿਕਟਾਂ ਹੋ ਰਹੀਆਂ ਹਨ ਜਿਵੇਂ ਕਿ ਅਣਜਾਨ ਲਿੰਕ ਜਾਂ ਪਲੇਟਫਾਰਮ ਤੋਂ ਕਦੇ ਨਾ ਕੀਤੇ ਹੋ ਗਏ ਅਪਡੇਟ ਤਾਂ ਇਹ ਸੰਕੇਤ ਹੈ ਕਿ ਤੁਹਾਡਾ ਅਕਾਊਂਟ ਹੈਕ ਹੋ ਚੁੱਕਾ ਹੈ ਤੁਹਾਡੇ ਅਕਾਊਂਟ ਤੋਂ ਅਨ ਪਛਤਾਤੇ ਮੈਸਜ ਜਾਂ ਸਪੈਮ ਨੰਬਰਾਂ ਨੂੰ ਜੇਕਰ ਭੇਜੇ ਜਾ ਰਹੇ ਹਨ ਤਾਂ ਕੋਈ ਵੀ ਨਹੀਂ ਜਾਣਦਾ ਕਿ ਇਹ ਕਿਵੇਂ ਭੇਜੇ ਗਏ ਤਾਂ ਇਹ ਇੱਕ ਹੋਰ ਇਸ਼ਾਰਾ ਹੈ ਕਿ ਤੁਹਾਡਾ ਅਕਾਊਂਟ ਹੈਕ ਹੋਇਆ ਹੈ ਜੇ ਤੁਸੀਂ ਦੇਖਦੇ ਹੋ ਕਿ ਤੁਸੀਂ ਕਦੇ ਵੀ ਕਿਸੇ ਵਿਸ਼ੇਸ਼ ਪੋਸਟ ਜਾਂ ਐਕਟੀਵਿਟੀ 'ਤੇ ਕਲਿੱਕ ਨਹੀਂ ਕੀਤਾ ਅਤੇ ਉਹ ਤੁਹਾਡਾ ਪ੍ਰੋਫਾਈਲ ਹੈ ਤਾਂ ਤੁਹਾਡੇ ਕੰਮ ਐਨੋਮਲਸ ਐਕਟੀਵਿਟੀ ਹੋ ਸਕਦੀ ਹੈ ਜੇ ਤੁਸੀਂ ਲਵਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਅਜੀਬ ਜਾਂ ਅਲੋਗੋ ਸੂਚਨਾ ਮਿਲ ਰਹੀ ਹੈ ਜਿਵੇਂ ਕਿ ਅਜੀਬ ਸਥਾਨਾਂ ਦਾ ਜਾਂ ਟਾਈਮ ਇਹ ਸੰਕੇਤ ਹੋ ਸਕਦਾ ਕਿ ਤੁਹਾਡੇ ਅਕਾਊਂਟ ਤੋਂ ਬਾਹਰ ਹੋ ਸਕਦਾ